ਹਾਂਜੀ ਹਾਂਜੀ ਹਾਂਜੀ ਹਾਂਜੀ ਦੱਸੋ ਜੀ ਸਾਡੇ ਕੋਲ ਕਾਰਾਂ ਉਪਲਬਧ ਹੈਗੀਆਂ ਦਿੱਲੀ ਨੰਬਰ ਦੀਆਂ ਹੈਗੀਆਂ ਕਾਫੀ ਕਾਰਾਂ ਉਪਲਬਧ ਹੈਗੀਆਂ ਇਹਨਾਂ ਵਿੱਚੋਂ ਬਲੀਨੋ ਹੈਗੀ ਹੈ ਐਲਟੋਸ ਹੈਗੀ ਹੈ ਸਵੀਫਟ ਹੈਗੀ ਹੈ ਡਿਜ਼ਾਇਰ ਹੈਗੀ ਹੈ ਅਤੇ ਐੱਸ ਯੂ ਵੀ ਗੱਡੀਆਂ ਦੇ ਵਿੱਚੋਂ ਐਕਸ ਯੂ ਵੀ ਸੈਵਨ ਹੰਡਰਡ ਹੈਗੀ ਹੈ ਅਤੇ ਤੁਸੀਂ ਕਿਹੜੀ ਗੱਡੀ ਲੈਣਾ ਪਸੰਦ ਕਰੋਗੇ ਕਿੰਨੇ ਕੁ ਪੈਸੇ ਲਾਉਣੇ ਹੈਗੇ ਹੈ ਪ੍ਰੋਵਾਈਡ ਕਰਾ ਦਿੰਦੇ ਡਿਜ਼ਾਇਰ ਸਾਡੇ ਕੋਲ ਅਵੇਲੇਬਲ ਹੈਗੀ ਹੈ ਜੀ ਵਾਈਟ ਕਲਰ ਹੈਗਾ ਟਾਇਰਾਂ ਦੀ ਕੰਡੀਸ਼ਨ ਵੀ ਵਧੀਆ ਹੈਗੀ ਹੈ ਅਤੇ ਹਾਲੇ ਟਾਈਮ ਵੀ ਹੁੰਦਾ ਕਾਫੀ ਪਿਆ ਹੈ ਉੱਚਾ ਮੋਡਲ ਵੀ ਹੈਗਾ ਸਾਡੇ ਕੋਲੇ ਕੰਡੀਸ਼ਨ ਬਹੁਤ ਵਧੀਆ ਹੈਗਾ ਏ ਸੀ ਪੂਰਾ ਉਹਦਾ ਵਰਕ ਕਰ ਰਿਹਾ ਹੈਗਾ ਹੈਗਾ ਅਤੇ ਨਾ ਲੱਗੀ ਨੀ ਜੀ ਅਤੇ ਆਟੋਮੈਟਿਕ ਹੈਗੀ ਸਾਡੇ ਕੋਲੇ ਅੱਛਾ ਆਟੋਮੈਟਿਕ ਪਸੰਦ ਕਰੋਂਗੇ ਗੱਡੀ ਅੱਜ ਕੱਲ੍ਹ ਜਮਾਨਾਂ ਹੀ ਆਟੋਮੈਟਿਕ ਦਾ ਆ ਗਿਆ ਹੈਗਾ ਗੇਅਰ ਲੈੱਸ ਹੈਗੀ ਜਿਹੜੀ ਤੁਹਾਨੂੰ ਚਲਾਉਣੀ ਸੋਖੀ ਹੋ ਜਾਂਦੀ ਹੈਗੀ ਕੋਈ ਗੇਅਰ ਨਹੀਂ ਪੈਂਦਾ ਹੈਗਾ ਅਤੇ ਬਹੁਤ ਵਧੀਆ ਗੱਡੀ ਹੈਗੀ ਹੈ ਕਲਰ ਵੀ ਵਾਈਟ ਹੈਗਾ ਉਹਦਾ ਅਤੇ ਇਸ ਕਰਕੇ ਤੁਸੀਂ ਜਿਹੜੀ ਗੱਡੀ ਜਿਹੜੀ ਹੈਗੀ ਦੇਖ ਲਓ ਆ ਕੇ ਗੱਡੀ ਜਿਹੜੀ ਹੈਗੀ ਬਹੁਤ ਵਧੀਆ ਸਾਡੇ ਕੋਲ ਉੱਚਾ ਮਾਡਲ ਦੇ ਵਿੱਚ ਉਪਲਬਧ ਹੈਗੀ ਹੈ ਔਰ ਸੈਂਟਰੋ ਸੈਂਟਰੋ ਵੀ ਹੈਗੀ ਹੈਗੀ ਹੈ ਅਤੇ ਸਾਡੇ ਕੋਲ ਅਵੇਲੇਬਲ ਇਸ ਕਰਕੇ ਗੱਡੀ ਹੈਗੀ ਤੁਸੀਂ ਆ ਕੇ ਦੇਖ ਜੋ ਅਤੇ ਕੋਈ ਤੁਹਾਨੂੰ ਮਤਲਬ ਹਰ ਪ੍ਰਕਾਰ ਦੇ ਸਾਡੀ ਜਿਹੜੀ ਹੈਗੀ ਹੈ ਗਰੰਟੀ ਹੋਵੇਗੀ ਸਰਵਿਸ ਵੀ ਅਸੀਂ ਅਸੀਂ ਸਾਡੇ ਹੈਗੇ ਨਾ ਕਾਰ ਬਜ਼ਾਰ ਪ੍ਰੋਵਾਈਡ ਕਰ ਰਹੇ ਆ ਜਿਹੜਾ ਵੀ ਸਾਡੇ ਕੋਲੋ ਕਸਟਮਰ ਲੈ ਕੇ ਜਾਂਦਾ ਹੈ